ਅਸੀਂ ਪਿਛਲੇ ਸਾਲ ਦੀ ਗੱਲ ਹੈ ਕਿ ਵੱਡੇ ਦਿਨਾਂ ਦੀਆਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਦਸੰਬਰ ਦੇ ਮਹੀਨੇ ਵਿੱਚ ਸੋਚਿਆ ਕਿ ਵਰਿੰਦਾਵਨ ਦਰਸ਼ਨਾਂ ਲਈ ਚੱਲੀਏ ਉੱਥੇ ਜਾ ਕੇ ਇੰਨਾ ਵਧੀਆ ਲੱਗਾ ਅਸੀਂ ਸਭ ਇਕੱਠੇ ਗਏ ਮੇਰੇ ਬੱਚੇ ਮੇਰੇ ਹਸਬੈਂਡ ਮੈਂ ਮੇਰੀ ਮਦਰ ਇਨ ਲੋ ਸਾਰੇ ਅਸੀਂ ਇਕੱਠੇ ਗਏ ਮੈਂ ਪਹਿਲਾਂ ਜਦੋਂ ਵਿਆਹ ਤੋਂ ਪਹਿਲਾਂ ਸਿਰਫ਼ ਸੁਣਿਆ ਸੀ ਕਿ ਵਰਿੰਦਾਵਨ ਬਹੁਤ ਅੱਛੀ ਜਗ੍ਹਾ ਹੈ ਉੱਥੇ ਠਾਕੁਰ ਜੀ ਸਾਕਸ਼ਾਤ ਮਿਲਦੇ ਹੈ ਲੇਕਿਨ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਬੱਚੇ ਹੋਏ ਤਾਂ ਮੰਮੀ ਨੇ ਕਿਹਾ ਕਿ ਇੱਕ ਦਿਨ ਮੈਂ ਵੀ ਸੋਚਿਆ ਕਿ ਮੰਮੀ ਸਾਨੂੰ ਵੀ ਵਰਿੰਦਾਵਨ ਲੈ ਕੇ ਚੱਲੋ ਉੱਥੇ ਕੀ ਐਸਾ ਖ਼ਾਸ ਹੈ ਹਮੇਸ਼ਾ ਮੈਂ ਆਪਣੀ ਮਦਰ ਇਨ ਲੋ ਦੇ ਮੂੰਹੋਂ ਸੁਣਿਆ ਸੀ ਕਿ ਉੱਥੇ ਸੱਚ ਮੁੱਚ ਠਾਕੁਰ ਜੀ ਰਹਿੰਦੇ ਹੈ ਜਦੋਂ ਅਸੀਂ ਗਏ ਅਤੇ ਅਸੀਂ ਪਹੁੰਚੇ ਉੱਥੇ ਬਹੁਤ ਰਸ਼ ਸੀ ਲੇਕਿਨ ਦਰਸ਼ਨ ਇੰਨੇ ਵਧੀਆ ਹੋਏ ਕਿ ਸਾਕਸ਼ਾਤ ਇਸ ਤਰ੍ਹਾਂ ਹੀ ਲੱਗਦਾ ਸੀ ਜਿਸ ਤਰ੍ਹਾਂ ਸਵਰਗ 'ਚ ਆ ਗਏ ਹਾਂ ਇਸ ਤਰ੍ਹਾਂ ਉੱਥੇ ਬਾਂਕੇ ਬਿਹਾਰੀ ਮੰਦਿਰ ਜਾ ਕੇ ਇਸ ਤਰ੍ਹਾਂ ਲੱਗੇ ਕਿ ਜਿਸ ਤਰ੍ਹਾਂ ਪਰਮਾਤਮਾ ਬਿਲਕੁਲ ਸਾਹਮਣੇ ਖੜ੍ਹੇ ਆ ਸਾਡੇ ਨਾਲ ਗੱਲਬਾਤ ਕਰ ਰਹੇ ਹੈ ਸਾਨੂੰ ਦੇਖ ਰਹੇ ਹੈ ਉਸ ਥੋਂ ਆ ਕੇ ਮੇਰੇ ਵਿੱਚ ਇੰਨਾ ਪਰਿਵਰਤਨ ਆਇਆ ਕਿ ਪਹਿਲੇ ਮੈਂ ਹੋਰ ਤਰ੍ਹਾਂ ਦੀ ਲੱਗਦਾ ਸੀ ਕਿ ਮੇਰਾ ਇਕਦਮ ਸਭ ਕੁਛ ਹੀ ਬਦਲ ਗਿਆ ਹੁਣ ਕਈ ਵਾਰੀ ਫੋਨ ਦੇ ਵਿੱਚ ਇੰਸਟਾਗ੍ਰਾਮ ਫੇਸਬੁੱਕ ਚਲਾਉਂਦੇ ਹਾਂ ਦੇਖ ਲੈਂਦੀ ਹਾਂ ਅਤੇ ਇੱਕਦਮ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦੇ ਧਾਮ ਹੀ ਪਹੁੰਚ ਗਈ ਹਾਂ ਇੰਨਾ ਵਧੀਆ ਲੱਗਾ ਉੱਥੇ ਜਾ ਕੇ ਇੱਕ ਇਸ ਟੂਰ ਨੇ ਕਹਿ ਲਉ ਕਿ ਮੇਰੀ ਜ਼ਿੰਦਗੀ ਬਦਲ ਦਿੱਤੀ ਮੈਨੂੰ ਠਾਕੁਰ ਜੀ ਨਾਲ ਇਸ ਤਰ੍ਹਾਂ ਇੱਕੋ ਵਾਰੀ 'ਚ ਮੈਂ ਜੁੜ ਜਾਵਾਂਗੀ ਮੈਂ ਕਦੇ ਨਹੀਂ ਸੀ ਸੋਚਿਆ ਲੇਕਿਨ ਚਲੋ ਪਰਮਾਤਮਾ ਦੀ ਕਿਰਪਾ ਹੋਈ ਅਸੀਂ ਗਏ ਇੱਕ ਬਹਾਨਾ ਹੀ ਬਣਿਆ ਕਿ ਮੇਰੇ ਜੀਵਨ ਦਾ ਉਦੇਸ਼ ਏ ਬਦਲ ਗਿਆ ਇੰਨਾ ਪਰਿਵਰਤਨ ਜੀਵਨ ਦੇ ਵਿੱਚ ਲੱਗ ਰਿਹਾ ਹੈ ਕਿ ਜਦੋਂ ਕੋਈ ਵੀ ਦੁੱਖ ਸੁੱਖ ਆਉਂਦਾ ਸਭ ਤੋਂ ਪਹਿਲੇ ਉਹੀ ਅੱਖਾਂ ਅੱਗੇ ਆ ਜਾਂਦੇ ਆ ਅਤੇ ਮੇਰਾ ਹਰ ਤਕਲੀਫ਼ ਹਰ ਚੀਜ਼ ਇੱਕਦਮ ਇੰਝ ਹੁੰਦਾ ਹੈ ਕਿ ਜਿਸ ਤਰ੍ਹਾਂ ਸਭ ਕੁਛ ਸਾਰੇ ਹੀ ਦੁੱਖ ਟਲ ਗਏ ਉਹਨਾਂ ਨੇ ਆ ਕੇ ਸਭ ਕੁਛ ਆਪਣੇ ਆਪ ਹੀ ਠੀਕ ਕਰ ਤਾ